ਮੱਛੀ ਟਾਂਕਾ ਜਿਹੜਾ ਹੈ ਉਹ ਸਭ ਤੋਂ ਚੁਣੌਤੀਪੂਰਨ ਹੈ ਕਿਉਂਕਿ ਉਸਨੂੰ ਕਰਨ ਵਿੱਚ ਬੜਾ ਟਾਈਮ ਲੱਗਦਾ ਹੈ ਔਰ ਬੜਾ ਧਿਆਨ ਨਾਲ ਉਸਨੂੰ ਕਰਨਾ ਲੱਗਦਾ ਹੈ ਪਰ ਉਹ ਫਲਦਾਇਕ ਵੀ ਬਹੁਤ ਹੈ ਕਿਉਂਕਿ ਜਦੋਂ ਬਣ ਕੇ ਤਿਆਰ ਹੁੰਦਾ ਮੱਛੀ ਟਾਂਕੇ ਨਾਲ ਕੋਈ ਵੀ ਚੀਜ਼ ਅਸੀਂ ਬਣਾਉਂਦੇ ਹਾਂ ਮੱਛੀ ਟਾਂਕੇ ਨਾਲ ਤਾਂ ਉਹ ਬਹੁਤ ਹੀ ਵਧੀਆ ਲੱਗਦੀ ਹੈ ਔਰ ਮੇਰਾ ਸਭ ਤੋਂ ਔਖਾ ਪਹਿਰਾਵਾ ਜਿਹੜਾ ਹੈ ਉਹ ਹੈ ਸਾੜੀ ਇਸਨੂੰ ਬੰਨਣ ਵਿੱਚ ਲਗਾਉਣ ਵਿੱਚ ਮੈਨੂੰ ਘੱਟ ਤੋਂ ਘੱਟ ਪੰਦਰਾਂ ਜਾਂ ਵੀਹ ਮਿੰਟ ਲੱਗਦੇ ਹਨ ਔਰ ਇਸਨੂੰ ਲਗਾ ਕੇ ਜਦੋਂ ਚੱਲਣਾ ਹੈ ਉਹ ਹੋਰ ਵੀ ਮੁਸ਼ਕਿਲ ਲੱਗਦਾ ਇਸ ਲਈ ਮੇਰਾ ਸਭ ਤੋਂ ਔਖਾ ਪਹਿਰਾਵਾ ਜਿਹੜਾ ਹੈ ਉਹ ਸਾੜੀ ਹੈ